ਜਦੋਂ ਵੀ ਕਿਸੇ ਝਗੜੇ ਦੇ ਵਿੱਚ ਕੋਈ ਵੀ ਖਾਸ ਕਰਕੇ ਪੇਂਡੂ ਲੋਕ ਜਿਹੜੇ ਅਨਪੜ੍ਹ ਜਾਂ ਮੈਂ ਹੁਣ ਇਹ ਕਵਾਂਗਾ ਕਿ ਘੱਟ ਪੜ੍ਹੇ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਪੁਲਿਸ ਦੇ ਰਵੱਈਏ ਦਾ ਸਾਹਮਣਾ ਕਰਨਾ ਪੈਂਦਾ ਪੁਲਿਸ ਠੀਕ ਤਰ੍ਹਾਂ ਨਾਲ ਡਿਊਟੀ ਨਹੀਂ ਕਰਦੀ ਭਰਿਸ਼ਟਾਚਾਰ ਇੰਨਾ ਫੈਲਿਆ ਹੋਇਆ ਕਿ ਜੋ ਕਾਰਵਾਈ ਦੋਸ਼ੀ 'ਤੇ ਹੋਣੀ ਚਾਹੀਦੀ ਹੁੰਦੀ ਹੈ ਉਹ ਸਗੋਂ ਉਲਟਾ ਮਦਈ 'ਤੇ ਕੀਤੀ ਜਾਂਦੀ ਕਈ ਵਾਰਾਂ ਮਦਈ ਦੀ ਗੱਲ ਸੁਣੀ ਨਹੀਂ ਜਾਂਦੀ ਕਈ ਵਾਰ ਮਦਈ ਦੇ ਕਹਿਣ 'ਤੇ ਰਪਟ ਲਿਖੀ ਨਹੀਂ ਜਾਂਦੀ ਕਈ ਵਾਰ ਲਪ ਰਪਟ ਗਲਤ ਲਿਖੀ ਜਾਂਦੀ ਹੈ ਜਾਂ ਉਹਦੇ ਵਿੱਚ ਜਿਹੜੇ ਤੱਥ ਹੁੰਦੇ ਆ ਉਹ ਤੋੜ ਮਰੋੜ ਕੇ ਪੇਸ਼ ਕੀਤੇ ਜਾਂਦੇ ਆ ਜਿਹੜੇ ਕਿ ਲਿਖਾਉਣ ਵਾਲੇ ਦੇ ਮਦਈ ਦੇ ਮਤਲਬ ਦੇ ਨਹੀਂ ਹੁੰਦੇ ਮਦਈ ਨਹੀਂ ਚਾਹੁੰਦਾ ਹੁੰਦਾ ਪਰ ਫਿਰ ਵੀ ਪੁਲਿਸ ਵੱਲੋਂ ਉਹ ਪਾ ਦਿੱਤਾ ਜਾਂਦਾ ਉਸ ਤੋਂ ਅੱਗੇ ਅਦਾਲਤ ਅਤੇ ਵਕੀਲ ਉੱਥੇ ਸਭ ਤੋਂ ਵੱਡੀ ਸਮੱਸਿਆ ਤਾਂ ਭਾਸ਼ਾ ਦੀਆਂ ਆਉਂਦੀ ਹੈ ਅਸੀਂ ਪੰਜਾਬ ਵਿੱਚ ਰਹਿਣ ਵਾਲੇ ਲੋਕ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਕਿੰਨੀ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਪਰ ਸਾਡੇ ਅੰਗਰੇਜ਼ ਦੇ ਜ਼ਮਾਨੇ ਤੋਂ ਚੱਲੀ ਆ ਰਹੀ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਹੀ ਅਦਾਲਤਾਂ ਵਿੱਚ ਹੁੰਦੀ ਜਦੋਂ ਕਿ ਹੋਰ ਹਿੰਦੁਸਤਾਨ ਦੇ ਬਹੁਤ ਸਾਰੇ ਸੂਬਿਆਂ 'ਚ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਅਦਾਲਤੀ ਕਾਰਵਾਈ ਹੁੰਦੀ ਹੈ ਪਰ ਪੰਜਾਬੀ 'ਚ ਕਿਉਂ ਨਹੀਂ ਹੁੰਦੀ ਜਿਹਦੀ ਮਦਈ ਜਾਂ ਦੂਸਰੇ ਵੀ ਪੱਖ ਨੂੰ ਚੰਗੀ ਤਰ੍ਹਾਂ ਸਮਝ ਆਉਂਦੀ ਰਵੇ ਜੱਜ ਦੇ ਸਾਹਮਣੇ ਤੁਹਾਡਾ ਵਕੀਲ ਕੀ ਬੋਲ ਰਿਹਾ ਅਸੀਂ ਸਿਰਫ ਇੱਕ ਮੂੰਹ ਹਿਲਣ ਦੀ ਖੇਡ ਦੇਖ ਰਹੇ ਹੁੰਦੇ ਹਾਂ ਸਾਨੂੰ ਨਹੀਂ ਪਤਾ ਹੁੰਦਾ ਕਿ ਸਾਡਾ ਵਕੀਲ ਦਲੀਲ ਕੀ ਦੇ ਰਿਹਾ ਬਹੁਤ ਥੋੜ੍ਹੇ ਲੋਕ ਜਿਹੜੇ ਅੰਗਰੇਜ਼ੀ ਭਾਸ਼ਾ ਤੋਂ ਜਾਣੂ ਹੁੰਦੇ ਉਹਦਾ ਕੁਝ ਨਾ ਕੁਝ ਸਮਝ ਜਾਂਦੇ ਫਿਰ ਜਦੋਂ ਚਲਦੀ ਭਾਸ਼ਾ ਚਾ ਅਫਸੋਸ ਚਲਦੀ ਬਹਿਸ ਦੇ ਦੌਰਾਨ ਕਦੇ ਕਦੇ ਵਕੀਲ ਆਪਣੇ ਸੈਲ ਨੂੰ ਕੋਈ ਨੁਕਤਾ ਪੁੱਛਦਾ ਤਾਂ ਉਹ ਡਡਬਾਰਾ ਹੋਇਆ ਦੇਖ ਰਿਹਾ ਹੁੰਦਾ ਕਿ ਮੈਨੂੰ ਹੁਣ ਕੀ ਪੁੱਛਣ ਲੱਗਿਆ ਉਹਨੂੰ ਕੁਝ ਪਤਾ ਨਹੀਂ ਲੱਗਦਾ ਇਸ ਕਰਕੇ ਅਦਾਲਤਾਂ 'ਚ ਪੁਲਸ ਸਟੇਸ਼ਨਾਂ 'ਚ ਜਾਂ ਵਕੀਲ ਦੇ ਅੱਡਿਆਂ 'ਤੇ ਇਹ ਸਿਰਫ ਇੱਕ ਖਜਲ ਖਵਾਰੀ ਬਣ ਰਹੀ ਹੈ ਅਦਾਲਤਾਂ ਨਿਆਂ ਦਾ ਸੋਮਾ ਹੁੰਦੀਆਂ ਹਨ ਨਿਆਂ ਦਾ ਮੰਦਰ ਹੁੰਦੀਆਂ ਹਨ ਪਰ ਅਸੀਂ ਉੱਥੇ ਨਿਆਂ ਕਦੇ ਨਹੀਂ ਦੇਖਦੇ ਖੱਜਲ ਖੁਆਰੀ ਦੇਖਦੇ